ਧਰਮ ਲੋਕਾਂ ਨੂੰ ਇਕੱਠੇ ਕਰਦਾ ਹੈ ਕਿਉਂਕਿ ਇਤਿਹਾਸ ਵਿੱਚ ਕਈ ਅਜਿਹੀਆਂ ਘਟਨਾਵਾਂ ਹੋਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਯਾਦ ਕਰਨ ਲਈ ਲੋਕ ਇਕੱਠੇ ਹੁੰਦੇ ਹਨ ਜਿਵੇਂ ਕਿ ਕਈ ਸ਼ਹੀਦੀ ਦਿਹਾੜੇ ਜਦੋਂ ਵੀ ਕੋਈ ਇਤਿਹਾਸ ਵਿੱਚ ਕੋਈ ਮੁੱਖ ਪ੍ਰਾਣੀ ਦੀ ਮੌਤ ਹੁੰਦੀ ਹੈ ਤਾਂ ਓਸੇ ਦਿਨ 'ਤੇ ਇੱਕ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਜਨਮ ਦਿਹਾੜੇ ਜਿਵੇਂ ਕਿ ਗੁਰੂਆਂ ਦੇ ਜਨਮ ਦਿਹਾੜੇ ਮੌਕੇ ਖੁਸ਼ੀ ਮਨਾਈ ਜਾਂਦੀ ਹੈ ਅਤੇ ਲੋਕ ਇਕੱਠੇ ਹੋ ਕੇ ਇਤਿਹਾਸ ਨੂੰ ਸੁਣਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਆਉਣ ਦਾ ਧਰਤੀ 'ਤੇ ਆਉਣ ਦਾ ਅਸਲੀ ਮਕਸਦ ਪਤਾ ਲੱਗਦਾ ਹੈ ਇਸ ਦੇ ਨਾਲ ਹੀ ਭਾਈਚਾਰੇ ਧਾਰਮਿਕ ਤਿਉਹਾਰ ਨੂੰ ਮਨਾਉਣ ਲਈ ਇਕੱਠੇ ਹੁੰਦਾ ਹੈ ਕਿਉਂ ਜਿਵੇਂ ਕਿ ਵਿਸਾਖੀ ਦੇ ਮੇਲੇ ਸਮੇਂ ਲੋਕ ਇਕੱਠੇ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਹੈ ਕਿਉਂਕਿ ਇਸ ਸਮੇਂ ਵਿਸਾਖੀ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਅਤੇ ਇਸ ਦੇ ਨਾਲ ਹੀ ਉਸ ਸਮੇਂ ਲੋਕਾਂ ਦੀਆਂ ਕਣਕਾਂ ਪੱਕੀਆਂ ਹੁੰਦੀਆਂ ਹਨ ਜਿਸ ਦੀ ਖੁਸ਼ੀ ਨੂੰ ਮਨਾਉਣ ਲਈ ਲੋਕ ਇਕੱਠੇ ਹੁੰਦੇ ਹਨ ਇਸ ਮੌਕੇ ਲੋਕ ਭੰਗੜਾ ਪਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਲੰਗਰ ਵੀ ਲਗਾਏ ਜਾਂਦੇ ਹਨ ਜਿਵੇਂ ਕਿ ਜਲੇਬੀਆਂ ਆਦਿ ਇਸ ਮੌਕੇ ਲੋਕਾਂ ਵਿੱਚ ਕੋਈ ਗਿਲੇ ਸ਼ਿਕਵੇ ਨਹੀਂ ਰਹਿੰਦੇ ਅਤੇ ਲੋਕ ਆਪਣੇ ਸਾਰੇ ਦੁੱਖਾਂ ਨੂੰ ਭੁੱਲ ਕੇ ਖੁਸ਼ੀ ਮਨਾਉਂਦੇ ਹਨ ਧੰਨਵਾਦ